ਮੈਨੂੰ ਜ਼ਿਆਦਾਤਰ ਕੀ ਘੁੰਮਣ ਫਿਰਨ ਦਾ ਸ਼ੌਕ ਨਹੀਂ ਹੈ ਪਰ ਮੈਨੂੰ ਜੇ ਯਾਤਰਾ ਕਰਨ ਦੇ ਲਈ ਕਿਹਾ ਜਾਂਦਾ ਹੈ ਤਾਂ ਮੈਨੂੰ ਸਭ ਤੋਂ ਵੱਧ ਯਾਦ ਆਉਂਦੀ ਹੈ ਦਰਬਾਰ ਸਾਹਿਬ ਦੀ ਯਾਤਰਾ ਅਸੀਂ ਦਰਬਾਰ ਸਾਹਿਬ ਗਏ ਸੀ ਉੱਥੇ ਦਾ ਸਕੂਨ ਉੱਥੇ ਦੀ ਸ਼ਾਂਤੀ ਉੱਥੇ ਦਾ ਵਾਤਾਵਰਨ ਮੈਨੂੰ ਬਹੁਤ ਅੱਛਾ ਲੱਗਿਆ ਸੀ ਅਤੇ ਉਹ ਅਨੁਭਵ ਮੈਂ ਕਦੇ ਵੀ ਨਹੀਂ ਭੁੱਲ ਸਕਦੀ ਮੈਨੂੰ ਉੱਥੇ ਅਗਰ ਜੇ ਮੈਨੂੰ ਦੁਬਾਰਾ ਮੌਕਾ ਮਿਲੇ ਤਾਂ ਮੈਂ ਦੁਬਾਰਾ ਵੀ ਦਰਬਾਰ ਸਾਹਿਬ ਜਾਣਾ ਚਾਹੁੰਗੀ ਉੱਥੋਂ ਦੇ ਚਾਰ ਦਰਵਾਜ਼ੇ ਜੋ ਹਿੰਦੂ ਮੁਸਲਿਮ ਸਿੱਖ ਈਸਾਈ ਚਾਰਾਂ ਲਈ ਖੁੱਲ੍ਹੇ ਹਨ ਉਹ ਇੱਕ ਵੱਖਰਾ ਨਜ਼ਾਰਾ ਹੈ ਉਸ ਨੂੰ ਦਰਬਾਰ ਸਾਹਿਬ ਦਾ ਨਾਂ ਹਰਿਮੰਦਰ ਸਾਹਿਬ ਜੋ ਕਿ ਹਰੀ ਕਾ ਮੰਦਰ ਦੇ ਨਾਮ ਨਾਲ ਇੱਕ ਰਾਹਤ ਹੈ ਸਭ ਇੱਕ ਅਜ਼ਾਦੀ ਹੈ ਇੱਥੇ ਇੱਕ ਸਕੂਨ ਹੈ ਸ਼ਾਂਤੀ ਹੈ ਮੈਨੂੰ ਇਹ ਯਾਤਰਾ ਕਦੇ ਵੀ ਨਹੀਂ ਭੁੱਲਦੀ ਮੈਂ ਆਪਣੀ ਫੈਮਿਲੀ ਦੇ ਨਾਲ ਗਈ ਸੀ ਪੂਰੀ ਨਾਨਕਿਆਂ ਦੀ ਫੈਮਿਲੀ ਦੇ ਨਾਲ ਅਸੀਂ ਸਾਰਿਆਂ ਨੇ ਬਹੁਤ ਇੰਨਜੋਏ ਕੀਤਾ ਗੱਲਾਂ ਮਾਰੀਆਂ ਇਕੱਠੇ ਬਹੁਤ ਕਦੀ ਇਹੋ ਜਿਹਾ ਸਮਾਂ ਨਹੀਂ ਮਿਲਦਾ ਹੁੰਦਾ ਕਿ ਇਕੱਠੇ ਜਾਈਏ ਸਾਡੀ ਜੋਇੰਟ ਫੈਮਿਲੀ ਸੀ ਹੁਣ ਸਾਰੇ ਡਿਫਰ ਅਲੱਗ ਅਲੱਗ ਹੋ ਗਏ ਪਰ ਉਸ ਟਾਈਮ ਅਸੀਂ ਸਾਰੇ ਇਕੱਠੇ ਗਏ ਸੀ ਮੇਰੇ ਕਜ਼ਨ ਸੀ ਮੇਰੇ ਮਾਮਾ ਮਾਮੀ ਹੋਰੀ ਸੀ ਮੰਮੀ ਡੈਡੀ ਸੀਗੇ ਸਾਰੇ ਮਤਲਬ ਇੱਕ ਇਹੋ ਜਿਹਾ ਮਾਹੌਲ ਸੀ ਜੋ ਮੈਨੂੰ ਹਰ ਟਾਈਮ ਸਕੂਨ ਦਿੰਦਾ ਹੈ ਮੈਂ ਜਦੋਂ ਵੀ ਯਾਦ ਕਰਾਂ ਤਾਂ ਮੈਨੂੰ ਸ਼ਾਂਤੀ ਮਿਲਦੀ ਹੈ ਜੇ ਆਪਾਂ ਸੂਰਜ ਚੜ੍ਹਨ ਅਤੇ ਡੁੱਬਣ ਦੀ ਗੱਲ ਕਰੀਏ ਤਾਂ ਮੇਰੇ ਘਰ ਦੇ ਨਾਲ ਖੇਤ ਸੀਗੇ ਹੁਣ ਘਰ ਬਦਲ ਚੁੱਕਿਆ ਹੈ ਪਰ ਉਸ ਤੋਂ ਪਹਿਲਾਂ ਘਰ ਦੇ ਨਾਲ ਖੇਤ ਸੀਗੇ ਘਰ ਜਦੋਂ ਜੀਰੀ ਲੱਗਣ ਤੋਂ ਪਹਿਲਾਂ ਪਾਣੀ ਵਾਹ ਕੇ ਛ ਛੱਡਿਆ ਜਾਂਦਾ ਹੈ ਤਾਂ ਪਾਣੀ ਬਿਲਕੁਲ ਠਹਿਰ ਜਾਂਦਾ ਹੈ ਉਸ ਦੇ ਵਿੱਚ ਸੂਰਜ ਨੂੰ ਚੜ੍ਹਦੇ ਦੇਖਣਾ ਉਸ ਪਾਣੀ ਵਿੱਚ ਸੂਰਜ ਦੀ ਚੜ੍ਹਦੇ ਦੀ ਪਰਛਾਈ ਅਤੇ ਪਾ ਸੂਰਜ ਵਿੱਚ ਡੁੱਬਦੇ ਦੀ ਪਰਛਾਈ ਨੂੰ ਦੇਖਣਾ ਬਹੁਤ ਹੀ ਸਕੂਨ ਦਾ ਨਜ਼ਾਰਾ ਹੁੰਦਾ ਹੈ